ਸਾਡੇ ਖੇਤਰ ਵਿੱਚ ਅਕਸਰ ਕਈ ਸ ਕਈ ਤਰ੍ਹਾਂ ਦੇ ਸੈਲਾਨੀ ਬਾਹਰ ਤੋਂ ਆਉਂਦੇ ਰਹਿੰਦੇ ਹਨ ਠੀਕ ਹੈ ਅਤੇ ਸਾਡੇ ਖੇਤਰ ਦਾ ਮੁਆਵਜ਼ਾ ਕਰਦੇ ਰਹਿੰਦੇ ਹਨ ਮੈਨੂੰ ਵੀ ਇੱਕ ਵਾਰ ਮੌਕਾ ਮਿਲਿਆ ਕਿ ਮੈਂ ਕਿਸੇ ਸੈਲਾਨੀ ਨਾਲ ਗੱਲਬਾਤ ਕਰਾਂ ਠੀਕ ਹੈ ਉਹ ਸੈਲਾਨੀ ਬਾਹਰ ਇਟਲੀ ਤੋਂ ਆਏ ਹੋਏ ਸੀ ਠੀਕ ਹੈ ਉਨ੍ਹਾਂ ਨਾਲ ਮੈਨੂੰ ਉਨ੍ਹਾਂ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਸ ਤਰ੍ਹਾਂ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਕਲਚਰ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ ਠੀਕ ਹੈ ਅਤੇ ਹੋਰ ਉਨ੍ਹਾਂ ਦੇ ਸੁਭਾਅ ਬਾਰੇ ਉਨ੍ਹਾਂ ਦੇ ਨੇਚਰ ਪੱਖੋਂ ਬਾਰੇ ਸਭ ਕੁਛ ਪਤਾ ਲੱਗ ਗਿਆ ਠੀਕ ਹੈ ਉਨ੍ਹਾਂ ਨੇ ਬਾਹਰ ਦੇ ਸੈਲਾਨੀਆਂ ਨੇ ਮੈਨੂੰ ਆਪਣੇ ਦੇਸ਼ ਦੀ ਭਾਸ਼ਾ ਇਟਾਲੀਅਨ ਵੀ ਸਿਖਾਈ ਅਤੇ ਉਸ ਨੇ ਉਨ੍ਹਾਂ ਨੇ ਆਪਣੇ ਭਾਸ਼ ਆਪਣੇ ਆਪਣੇ ਦੁਆਰਾ ਆਪਣੇ ਉੱਧਰ ਉਸ ਉਸ ਸਾਈਡ ਦੇ ਸੰਸਕ੍ਰਿਤ ਕਹਿ ਲਓ ਜਾਂ ਕਹਿ ਲਓ ਆਪਣੇ ਖੇਡਾਂ ਹੈਗੀਆਂ ਜਾਂ ਕੁਛ ਹੋਰ ਚੀਜ਼ਾਂ ਬਾਰੇ ਵੀ ਬਹੁਤ ਸ ਬਹੁਤ ਜ਼ਿਆਦਾ ਜਾਗਰੂਕ ਜਾਗਰੂਕ ਕਰਾਇਆ ਅਤੇ ਮੈਨੂੰ ਉਨ੍ਹਾਂ ਨਾਲ ਮਿਲ ਕੇ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੋਇਆ